ਨਮਸ਼ਕਾਰ ਭਾਅ ਜੀ ਜਿੱਦਾਂ ਕਿ ਮੈਂ ਦੇਖ ਪਾ ਰਹੀ ਹਾਂ ਆਪਣੇ ਫੋਨ ਵਿੱਚ ਮੈਪ ਰਾਹੀਂ ਕਿ ਸਾਡੇ ਨਿਰਧਾਰਿਤ ਸਥਾਨ ਯਾਨੀ ਕਿ ਸਾਡੇ ਕੋਲੇਜ ਪੁੱਜਣ ਦੀ ਦੂਰੀ ਹੁਣ ਕੁਛ ਹੀ ਰਹਿ ਗਈ ਹੈ ਯਾਨੀ ਕਿ ਅੱਧੇ ਘੰਟੇ ਤੱਕ ਹੁਣ ਅਸੀਂ ਆਪਣੇ ਕਾਲਜ ਵਿੱਚ ਪਹੁੰਚ ਜਾਵਾਂਗੇ ਪਰ ਸ ਮੈਂ ਦੇਖ ਪਾ ਰਹੀ ਹਾਂ ਕਿ ਸਾਡੇ ਸਾਹਮਣੇ ਸੜਕ ਖਰਾਬ ਹੈ ਸੜਕ ਵਿੱਚ ਕੰਮ ਲੱਗਿਆ ਹੋਇਆ ਹੈ ਅਤੇ ਉਹਨਾਂ ਨੇ ਆਵਾਜਾਈ ਬੰਦ ਕੀਤੀ ਹੋਈ ਹੈ ਪਰ ਮੈਂ ਆਪਣੇ ਕੋਲੇਜ ਵਿੱਚ ਪਹੁੰਚਣਾ ਹੈ ਕਿਉਂਕਿ ਮੇਰਾ ਅੱਜ ਕਾਲਜ ਵਿੱਚ ਬਹੁਤ ਹੀ ਜ਼ਰੂਰੀ ਕੰਮ ਹੈ ਪਰ ਸੜਕ ਬੰਦ ਹੋਣ ਕਰਕੇ ਇਸ ਰਸਤਿਓਂ ਕੋਲੇਜ ਜਾਣਾ ਸ ਸਾਡਾ ਮੁਮਕਿਨ ਨਹੀਂ ਹੈ ਪਰ ਮੇਰਾ ਕੋਲੇਜ ਜਾਣਾ ਅੱਜ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕਾਲਜ ਵਿੱਚ ਮੇਰੇ ਹਸਤਾਕਸ਼ਰ ਹੋਣੇ ਹਨ ਜਿਸ ਦੇ ਨਾਲ ਹੀ ਮੈਂ ਪ੍ਰੀਖਿਆ ਵਿੱਚ ਕੱਲ੍ਹ ਬੈਠ ਸਕਦੀ ਹਾਂ ਜੇਕਰ ਅੱਜ ਮੇਰੇ ਹਸਤਾਕਸ਼ਰ ਨਾ ਹੋਏ ਤਾਂ ਕੱਲ੍ਹ ਮੈਂ ਪ੍ਰੀਖਿਆ ਵਿੱਚ ਨਹੀਂ ਬੈਠ ਪਾਵਾਂਗੀ ਇਸ ਲਈ ਮੇਰਾ ਕੋਲੇਜ ਜਾਣਾ ਬਹੁਤ ਜ਼ਰੂਰੀ ਹੈ ਪਰ ਰਸਤਾ ਬੰਦ ਹੋਣ ਕਰਕੇ ਮੇਰਾ ਕੋਲੇਜ ਜਾਣ ਦਾ ਰਸਤਾ ਹੁਣ ਮੈਨੂੰ ਚੇਂਜ ਕਰਨਾ ਪਏ ਪਵੇਗਾ ਪਰ ਜੇਕਰ ਅਸੀਂ ਆਪਣਾ ਰਸਤਾ ਚੇਂਜ ਕੀਤਾ ਤਾਂ ਸਾਨੂੰ ਕੁਝ ਸਮਾਂ ਵੱਧ ਲੱਗ ਜਾਵੇਗਾ ਕਾਲਜ ਜਾਣ ਵਿੱਚ ਪਰ ਮੈਂ ਹੁਣ ਜਲਦੀ ਤੋਂ ਜਲਦੀ ਹੀ ਕੋਲੇਜ ਪਹੁੰਚਣਾ ਹੈ ਕਿਉਂਕਿ ਕਾਲਜ ਪੁੱਜਣ ਦਾ ਟਾਈਮ ਸਾਡਾ ਥੋੜ੍ਹਾ ਹੀ ਰਹਿ ਗਿਆ ਹੈ ਜੇਕਰ ਮੈਂ ਲੇਟ ਹੋ ਗਈ ਤਾਂ ਉਹ ਬੰਦ ਹੋ ਜਾਵੇਗਾ ਅਤੇ ਮੇਰੇ ਹਸਤਾਕਸ਼ਰ ਨਹੀਂ ਹੋ ਪਾਣਗੇ ਅਤੇ ਮੈਂ ਪ੍ਰੀਖਿਆ ਵਿੱਚ ਨਹੀਂ ਬੈਠ ਪਾਵਾਂਗੀ ਪਰ ਮੈਨੂੰ ਪ੍ਰੀਖਿਆ ਵਿੱਚ ਬੈਠਣ ਲਈ ਜਲਦੀ ਤੋਂ ਜਲਦੀ ਕਾਲਜ ਪਹੁੰਚਣਾ ਪਵੇਗਾ ਕੀ ਤੁਸੀਂ ਮੈਨੂੰ ਕੋਈ ਹੋਰ ਰਸਤਿਓਂ ਜਲਦੀ ਤੋਂ ਜਲਦੀ ਕਾਲਜ ਲੈ ਕੇ ਜਾ ਸਕਦੇ ਹੋ ਕ੍ਰਿਪਾ ਕਰਕੇ ਮੈਨੂੰ ਜਲਦੀ ਦੱਸੋ ਕਿ ਜੇ ਅਸੀਂ ਕੋਈ ਹੋਰ ਰਸਤਾ ਅਪਣਾਈਏ ਤਾਂ ਅਸੀਂ ਆਪਣੇ ਕੁਛ ਸਮੇਂ ਵਿੱਚ ਹੀ ਯਾਨੀ ਕਿ ਜਲਦੀ ਤੋਂ ਜਲਦੀ ਹੀ ਕੋਲੇਜ ਪਹੁੰਚ ਸਕਦੇ ਹਾਂ ਮੇਰਾ ਕੋਲੇਜ ਪਹੁੰਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਅੱਜ ਇਹ ਸੜਕ ਖਰਾਬ ਨਾ ਹੁੰਦੀ ਤਾਂ ਅਸੀਂ ਜਲਦੀ ਤੋਂ ਜਲਦੀ ਹੀ ਇਸ ਰਸਤੇ ਤੋਂ ਕੋਲੇਜ ਪਹੁੰਚ ਜਾਣਾ ਸੀ ਪਰ ਇਸ ਸੜਕ ਦੇ ਖਰਾਬ ਹੋਣ ਕਰਕੇ ਅਸੀਂ ਕਾਲਜ ਨਹੀਂ ਪਹੁੰਚ ਸਕਦੇ ਸਾਨੂੰ ਕੋਲੇਜ ਪਹੁੰਚਣ ਲਈ ਕੋਈ ਹੋਰ ਰਸਤਾ ਅਪਣਾਉਣਾ ਪਵੇਗਾ ਅਤੇ ਜੇ ਅਸੀਂ ਕੋਈ ਹੋਰ ਰਸਤਾ ਅਪਣਾਉਂਦੇ ਹਾਂ ਤਾਂ ਸਾਨੂੰ ਟਾਈਮ ਜ਼ਿਆਦਾ ਲੱਗ ਸਕਦਾ ਹੈ ਪਰ ਸਾਡੇ ਕੋਲ ਟਾਈਮ ਵੀ ਬ ਘੱਟ ਹੈ ਜੇਕਰ ਅਸੀਂ ਟਾਈਮ ਜ਼ਿਆਦਾ ਲਾਇਆ ਤਾਂ ਕੋਲੇਜ ਬੰਦ ਹੋ ਜਾਉ ਹੋ ਜਾਊਗਾ ਜਿਸ ਨਾਲ ਮੇਰੇ ਹਸਤਾਕਸ਼ਰ ਜਿਹੜੇ ਹੈ ਉਹ ਨਹੀਂ ਹੋ ਪਾਣਗੇ ਕਿਰਪਾ ਕਰਕੇ ਮੈਨੂੰ ਕੋਈ ਹੋਰ ਛੋਟੇ ਤੋਂ ਛੋਟੇ ਰਸਤੇ ਵਿੱਚ ਲੈ ਕੇ ਜਲਦੀ ਚੱਲੋ ਤਾਂ ਕਿ ਮੇਰੇ ਹਸਤਾਕਸ਼ਰ ਹੋ ਜਾਣ ਜੇਕਰ ਤੁਸੀਂ ਇਹ ਕੰਮ ਕਰ ਦਓਗੇ ਤਾਂ ਮੈਂ ਤੁਹਾਡੀ ਬਹੁਤ ਹੀ ਜ਼ਿਆਦਾ ਧੰਨਵਾਦੀ ਹੋਵਾਂਗੀ ਕਿਰਪਾ ਕਰਕੇ ਮੈਨੂੰ ਕੋਈ ਹੋਰ ਰਸਤੇ ਤੋਂ ਲੈ ਕੇ ਚੱਲੋ ਤਾਂ ਕਿ ਮੈਂ ਜਲਦੀ ਤੋਂ ਜਲਦੀ ਕੋਲੇਜ ਪਹੁੰਚ ਸਕਾਂ ਅਤੇ ਆਪਣੇ ਹਸਤਾਕਸ਼ਰ ਕਰ ਸਕਾਂ ਕੀ ਤੁਸੀਂ ਮੈਨੂੰ ਜਲਦੀ ਤੋਂ ਜਲਦੀ ਪਹੁੰਚਾ ਸਕਦੇ ਹੋ ਜੇਕਰ ਤੁਹਾਨੂੰ ਕੋਈ ਹੋਰ ਰਸਤਾ ਪਤਾ ਹੈ ਤਾਂ ਮੈਨੂੰ ਦੱਸੋ ਕਿ ਮੈਨੂੰ ਕਿੰਨਾ ਚਿਰ ਲੱਗੇਗਾ ਉਸ ਰਸਤੇ ਤੋਂ ਕਿ ਮੈਂ ਆਪਣੇ ਕੋਲੇਜ ਨਿਰਧਾਰਿਤ ਸਮੇਂ 'ਤੇ ਪੁੱਜ ਸਕਾਂ ਧੰਨਵਾਦ